ਅਧਿਆਪਕ ਟੀਚਰ ਕਿਸੇ ਵੀ ਕੰਮ ਲਈ ਅਧਿਆਪਕ ਦਾ ਹੋਣਾ ਤਾਂ ਬਹੁਤ ਜ਼ਰੂਰੀ ਹੈ ਅਧਿਆਪਕ ਦੀ ਆਪਣੀ ਇੱਕ ਭੂਮਿਕਾ ਹੁੰਦੀ ਹੈ ਕਿਸੇ ਨੂੰ ਸਿੱਖਿਆ ਦੇਣ ਲਈ ਜਾਂ ਕਿਸੇ ਨੂੰ ਦੇਣ ਲਈ ਜਾਂ ਅਸੀਂ ਆਪ ਕੋਈ ਸਿੱਖਣਾ ਹੋਵੇ ਤਾਂ ਅਧਿਆਪਕ ਦੀ ਲੋੜ ਤਾਂ ਜ਼ਰੂਰ ਰਹਿੰਦੀ ਹੈ ਅਨੁਭਵ ਬਹੁਤ ਵਧੀਆ ਮਿਲਦਾ ਹੈ ਅਧਿਆਪਕ ਤੋਂ ਕਿਉਂਕਿ ਕਾਫੀ ਟਾਈਮ ਜੋ ਅਧਿਆਪਕ ਹੁੰਦਾ ਹੈ ਕਿਸੇ ਵੀ ਲਿਟਰੇਚਰ ਲਈ ਜਾਂ ਕਿਸੇ ਵੀ ਕਿਸੇ ਚੀਜ਼ ਦੀ ਵੀ ਸਿੱਖਿਆ ਲੈਣ ਲਈ ਅਧਿਆਪਕ ਦਾ ਪੁਰਾਣਾ ਅਨੁਭਵ ਹੁੰਦਾ ਹੈ ਅਤੇ ਉਸ ਤੋਂ ਉਸ ਦਾ ਅਨੁਭਵ ਲੈ ਕੇ ਅੱਗੇ ਸਟਾਰਟ ਕਰਨਾ ਜਾਂ ਉਹਦੇ ਤੋਂ ਸਿੱਖਣਾ ਤੁਹਾਨੂੰ ਡਬਲ ਜਾਂ ਟ੍ਰਿਪਲ ਜਾਂ ਤਿੰਨ ਗੁਣਾ ਸਾਨੂੰ ਫਾਇਦਾ ਦਿੰਦਾ ਹੈ ਜੇਕਰ ਮੇਰੀ ਗੱਲ ਕਰੀਏ ਤਾਂ ਮੇਰੇ ਕੋਲ ਅਜਿਹੇ ਅਧਿਆਪਕ ਹਨ ਜਿਹਨਾਂ ਤੋਂ ਅਲੱਗ ਅਲੱਗ ਗਾਇਨ ਦੇ ਤੌਰ 'ਤੇ ਜਾਂ ਅਲੱਗ ਅਲੱਗ ਵਿਗਿਆਨਕ ਤਰੀਕੇ ਨਾਲ ਵੀ ਸਮਝਾਉਂਦੇ ਹਨ ਜਾਂ ਮਤਲਬ ਪੁਰਾਣੇ ਡਾਟਾਬੇਸ ਚੱਕ ਕੇ ਜਾਂ ਕੋਈ ਪੁਰਾਣੀਆਂ ਉਹਨਾਂ ਦੇ ਜਿਹੜੇ ਉਹਨਾਂ ਨੇ ਸਿੱਖੇ ਹੋਏ ਨੇ ਉਹਨਾਂ ਦਾ ਬੈਨੀਫਿਟ ਲੈਣ ਲਈ ਕਾਫੀ ਅਧਿਆਪਕ ਤੋਂ ਇਹ ਜਾਣਕਾਰੀ ਲੈਣੀ ਪੈਂਦੀ ਹੈ ਇੱਕ ਤੋਂ ਤਾਂ ਨਹੀਂ ਹਾਂ ਇਸ ਚੀਜ਼ ਲਈ ਅਲੱਗ ਅਲੱਗ ਮਿਊਜ਼ਿਕ ਲਈ ਜਾਂ ਅਲੱਗ ਅਲੱਗ ਤਰ੍ਹਾਂ ਦੇ ਬੋਲਾਂ ਲਈ ਕਈ ਤਰ੍ਹਾਂ ਦੀਆਂ ਕੈਟੀਗਿਰੀਆਂ ਗਾਇਨ ਦੇ ਵਿੱਚ ਹੁੰਦੀਆਂ ਨੇ ਜਿਹਨਾਂ ਲਈ ਸਾਨੂੰ ਅਲੱਗ ਅਲੱਗ ਅਧਿਆਪਕ ਤੋਂ ਸਿੱਖਣਾ ਪੈਂਦਾ ਬਟ ਮੇਰੀ ਮੇਰਾ ਰੁਝਾਨ ਇਸ ਚੀਜ਼ ਵੱਲ ਇੰਨਾ ਵੱਧ ਗਿਆ ਕਿ ਮੈਨੂੰ ਅਗਰ ਹੋਰ ਵੀ ਕੋਈ ਮਿਲਦਾ ਨਾ ਤਾਂ ਮੈਂ ਉਸ ਤੋਂ ਟ੍ਰੇਨਿੰਗ ਜ਼ਰੂਰ ਲੈਂਦਾ ਹਾਂ ਅਧਿਆਪਕ ਤੋਂ ਸਿੱਖਣ ਨਾਲ ਇਹ ਹੁੰਦਾ ਕਿ ਅਗਰ ਕੁਛ ਕਮੀਆਂ ਪੇਸ਼ੀਆਂ ਹੁੰਦੀਆਂ ਹਨ ਤਾਂ ਉਹ ਨੈਕਸਟ ਇਨ ਜੀਵਨ ਵਿੱਚ ਅੱਗੋਂ ਉਹ ਉਹ ਗਲਤੀਆਂ ਨਹੀਂ ਹੁੰਦੀਆਂ ਇਸ ਕਰਕੇ ਅਧਿਆਪਕ ਦਾ ਹੋਣਾ ਕਿਸੇ ਵੀ ਕਿੱਤੇ ਲਈ ਅਧਿਆਪਕ ਦਾ ਹੋਣਾ ਜ਼ਰੂਰੀ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਅਧਿਆਪਕ ਤੋਂ ਸਿੱਖਿਆ ਲੈ ਕੇ ਤੁਸੀਂ ਵੀ ਇਸ ਚੀਜ਼ਾਂ ਦੇ ਵਿੱਚ ਕਾਮਯਾਬ ਹੋ ਸਕਦੇ ਹੋ ਹਾਂ ਇਹਦੇ ਵਿੱਚ ਇਹ ਹੈ ਕਿ ਟਾਈਮ ਬਦਲਣ ਨਾਲ ਨਵਾਂ ਨਵਾਂ ਮਿਊਜ਼ਿਕ ਨਵੇਂ ਨਵੇਂ ਗਾਇਨ ਨਵੀਂ ਤਰ੍ਹਾਂ ਦੀਆਂ ਆਵਾਜ਼ਾਂ ਅਗਰ ਸਾਨੂੰ ਸਿੱਖਣ ਨੂੰ ਮਿਲਦੀਆਂ ਰਹਿਣ ਤਾਂ ਉਹ ਜ਼ਿਆਦਾ ਵਧੀਆ ਇਸ ਕਰਕੇ ਅਗਰ ਮੈਨੂੰ ਹੋਰ ਵੀ ਆਉਣ ਵਾਲੇ ਟਾਈਮ ਦੇ ਵਿੱਚ ਅਧਿਆਪਕ ਮਿਲਣਗੇ ਤਾਂ ਮੈਂ ਉਹਨਾਂ ਨੂੰ ਉਹਨਾਂ ਤੋਂ ਸਿੱਖਿਆ ਜ਼ਰੂਰ ਲਵਾਂਗਾ